ਮੇਰੀ ਹੁਣ ਤੱਕ ਦੀ ਸਭ ਤੋਂ ਸੁੰਦਰ ਯਾਤਰਾ ਮਨੀਕਰਨ ਸਾਹਿਬ ਹੈ ਅਸੀਂ ਦੋ ਪਰਿਵਾਰ ਰਲ ਕੇ ਗਏ ਸੀ ਸਵੇਰੇ ਪੰਜ ਵਜੇ ਅਸੀਂ ਸਾਰੇ ਗੱਡੀ ਵਿੱਚ ਬੈਠ ਕੇ ਤੁਰ ਪਏ ਮਨੀਕਰਨ ਸਾਹਿਬ ਦੀ ਯਾਤਰਾ ਬਹੁਤ ਹੀ ਲੰਬੀ ਸੀ ਅਸੀਂ ਉੱਥੇ ਅੱਠ ਵਜੇ ਪਹੁੰਚੇ ਪਹੁੰਚਦੇ ਸਾਰ ਹੀ ਅਸੀਂ ਕਮਰੇ ਵਿੱਚ ਚਲੇ ਗਏ ਉਸ ਤੋਂ ਬਾਅਦ ਸਵੇਰੇ ਉੱਠ ਕੇ ਅਸੀਂ ਉੱਥੇ ਦਰਸ਼ਨ ਕੀਤੇ ਉੱਥੋਂ ਦੇ ਕੁਦਰਤ ਅਲੌਕਿਕ ਨਜ਼ਾਰੇ ਬਹੁਤ ਹੀ ਸੁੰਦਰ ਸਨ ਉੱਥੇ ਬਹੁਤ ਹੀ ਦੇਖਣਯੋਗ ਚੀਜ਼ਾਂ ਅਤੇ ਨਜ਼ਾਰੇ ਸਨ ਉੱਥੇ ਜਾ ਕੇ ਮੈਨੂੰ ਬਹੁਤ ਹੀ ਆਨੰਦ ਮਿਲਿਆ ਮਨੀਕਰਨ ਸਾਹਿਬ ਦੀ ਯਾਤਰਾ ਮੇਰੇ ਲਈ ਬਹੁਤ ਜ਼ਿਆਦਾ ਸੁੰਦਰ ਸੀ ਅਤੇ ਬਹੁਤ ਹੀ ਅਨੁਭਵੀ ਸੀ